ਸਾਡੇ ਖੇਤਰ ਵਿੱਚ ਬਹੁਤ ਮਨੋਰੰਜਨ ਦੀਆਂ ਗਤੀਆਂ ਵਿਧੀਆਂ ਹਨ ਇੱਕ ਸਾਡੇ ਸਾਡੇ ਕੋਲ ਲਾਗੇ ਹੀ ਇੱਕ ਵੀ ਆਰ ਪੰਜਾਬ ਮੋਲ ਹੈ ਉੱਥੇ ਬਹੁਤ ਵਧੀਆ ਹੀ ਵਧੀਆ ਮੋਲ ਹੈ ਉੱਥੇ ਫਨ ਸਿਟੀ ਵੀ ਹੈ ਉੱਥੇ ਕਈ ਤਰ੍ਹਾਂ ਦੀਆਂ ਖੇਡਾਂ ਵਗੈਰਾ ਖੇਡੀਆਂ ਜਾਂਦੀਆਂ ਹਨ ਅਤੇ ਬਹੁਤ ਮਜ਼ਾ ਆਉਂਦਾ ਹੈ ਅਤੇ ਮੋਹਾਲੀ ਦਾ ਸਰਕਾਰੀ ਸਕੂਲ ਦਾ ਗਰਾਊਂਡ ਬਹੁਤ ਵੱਡਾ ਹੈ ਉੱਥੇ ਕਈ ਤਰ੍ਹਾਂ ਕਈ ਤਰ੍ਹਾਂ ਦੀਆਂ ਇਹ ਝੂਲੇ ਵਗੈਰਾ ਲੱਗੇ ਹੋਏ ਹਨ ਅਤੇ ਬੱਚੇ ਬੜਾ ਮਨੋਰੰਜਨ ਕਰਦੇ ਹਨ ਅਤੇ ਉੱਥੇ ਸਾਨੂੰ ਜਾ ਕੇ ਬਹੁਤ ਵਧੀਆ ਲੱਗਦਾ ਹੈ ਅਤੇ ਘੁੰਮਣਾ ਫਿਰਨਾ ਵੀ ਵਧੀਆ ਲੱਗਦਾ ਹੈ